ਜਦੋਂ ਇਹ ਭੰਗੜਾ ਪਉਂਦੇ ਹਨ ਇਨ੍ਹਾਂ ਦੀ ਇੱਕ ਦੇਖਣਯੋਗ ਬਹੁਤ ਹੀ ਖ਼ਾਸ ਚੀਜ਼ ਹੈ ਜਦੋਂ ਇਹ ਭੰਗੜਾ ਪਾਉਂਦੇ ਹਨ ਇਨ੍ਹਾਂ ਦੇ ਹੱਥ ਵਿੱਚ ਇੱਕ ਸੋਟੀ ਹੁੰਦੀ ਹੈ ਅਤੇ ਇਹ ਸੋਟੀ ਨੂੰ ਮਿਊਜਿਕ ਦੇ ਹਿਸਾਬ ਨਾਲ ਘੁਮਾਉਂਦੇ ਹਨ ਇਹ ਡਾਂਸ ਬੜੇ ਉਤਸ਼ਾਹ ਨਾਲ ਕੀਤੇ ਜਾਂਦੇ ਹਨ ਅਤੇ ਇਹ ਡਾਂਸ ਇਕੱਠੇ ਹੋ ਕੇ ਕਰਦੇ ਹਨ ਅਤੇ ਜਦੋਂ ਲੋਕ ਇਕੱਠੇ ਹੋ ਕੇ ਇਹ ਭੰਗੜਾ ਪਾਉਂਦੇ ਹਨ ਤਾਂ ਮਨਾਂ ਵਿੱਚ ਇੱਕ ਦੂਜੇ ਲਈ ਪਿਆਰ ਭਾਈਚਾਰਾ ਅਤੇ ਸਦਭਾਵਨਾ ਪੈਦਾ ਹੁੰਦੀ ਹੈ ਅਤੇ ਲੋਕ ਇਹ ਭੰਗੜਾ ਮਿਲ ਜੁਲ ਕੇ ਪਾਉਂਦੇ ਹਨ ਅਤੇ ਜਦੋਂ ਲੋਕ ਇਹ ਭੰਗੜਾ ਪਉਂਦੇ ਹਨ ਤਾਂ ਲੋਕਾਂ ਵਿੱਚ ਪਿਆਰ ਭਾਈਚਾਰਾ ਵਧਾਉਣ ਵਿੱਚ ਕਾਫ਼ੀ ਯੋਗਦਾਨ ਪਾਉਂਦੇ ਹੈ ਅਤੇ ਲੋਕ ਭੰ ਭੰਗੜਾ ਕਰਦੇ ਸਮੇਂ ਇੱਕ ਦੂਜੇ ਨਾਲ ਹਾਸਾ ਮਜ਼ਾਕ ਅਤੇ ਪਿਆਰ ਇੱਕ ਦੂਜੇ ਲਈ ਜਾਗ੍ਰਿਤ ਕਰਦੇ ਹਨ ਜੋ ਕਿ ਇਹ ਭੰਗੜਾ ਮਿਲ ਜੁਲ ਕੇ ਇਕੱਠੇ ਰਹਿਣ ਦੀ ਭਾਵਨਾ ਨੂੰ ਜਾਗ੍ਰਿਤ ਕਰਦਾ ਹੈ